ਇੱਕ ਜਨਵਰੀ ਉੱਨੀ ਸੌ ਸੰਤਾਲੀ ਉੱਨੀ ਜਨਵਰੀ ਉੱਨੀ ਸੌ ਅਠਤਾਲੀ ਅਠਾਰ੍ਹਾਂ ਅਕਤੂਬਰ ਉੱਨੀ ਸੌ ਬਿਆਸੀ ਅਠਾਈ ਨਵੰਬਰ ਦੋ ਹਜ਼ਾਰ ਸੋਲ੍ਹਾਂ ਤਿੰਨ ਅਪ੍ਰੈਲ ਉੱਨੀ ਸੌ ਬਾਨਵੇਂ